ਮੈਂ ਇੱਕ ਅਧਿਆਪਕ ਹਾਂ ਅਤੇ ਮੈਂ ਬਹੁਤ ਸਾਰੇ ਸਕੂਲ ਜਾ ਕੇ ਕੰਮ ਕਰਨੇ ਹੁੰਦੇ ਆ ਜਿੱਦਾਂ ਕਿ ਟਰਮੀਨਲ ਐਗਜ਼ਾਮਸ ਹੁੰਦੇ ਆ ਬੱਚਿਆਂ ਦੇ ਉਸ ਤੋਂ ਬਾਅਦ ਉਹਨਾਂ ਦੇ ਰਿਪੋਰਟ ਕਾਰਡ ਤਿਆਰ ਕੀਤੇ ਜਾਂਦੇ ਆ ਉਹ ਰਿਪੋਰਟ ਕਾਰਡ ਮੈਂ ਸਕੂਲ ਨਹੀਂ ਤਿਆਰ ਕਰਦੀ ਮੈਂ ਘਰ ਲਿਆ ਕੇ ਤਿਆਰ ਕਰ ਲੈਂਦੀ ਹਾਂ ਤਾਂ ਕਿ ਕੋਈ ਡਿਸਟਰਬੈਂਸ ਨਾ ਹੋਵੇ ਅਤੇ ਮੈਂ ਜਦੋਂ ਘਰ ਲਿਆ ਕੇ ਤਿਆਰ ਕੀਤੇ ਤਾਂ ਇੱਕ ਦੋ ਰਿਪੋਰਟ ਕਾਰਡ ਜਿਹੜੇ ਹੈ ਉਹ ਮੇਰੇ ਕੋਲੋਂ ਗਲਤ ਹੋ ਗਏ ਇਸ ਕਰਕੇ ਜਦੋਂ ਮੈਨੂੰ ਆਪਣੀ ਗਲਤੀ ਦਾ ਪਤਾ ਲੱਗਾ ਕਿ ਇੰਝ ਰਿਪੋਰਟ ਕਾਰਡ ਗਲਤ ਹੋ ਗਏ ਹੈ ਅਤੇ ਮੈਂ ਵਿਚਾਰ ਕਰੀ ਅਤੇ ਇੱਕ ਵਾਈਟਨਰ ਲਿਆਉਂਦਾ ਉਹ ਵਾਈਟਨਰ ਲਗਾ ਕੇ ਥੋੜ੍ਹਾ ਜਿਹਾ ਉਹਨੂੰ ਵਾਈਟ ਕਰ ਦਿੱਤਾ ਅਤੇ ਦੁਬਾਰਾ ਉਹ ਰਿਪੋਰਟ ਕਾਰਡ ਜਿਹੜੇ ਹੈ ਉਹ ਭਰੇ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਕਿਹੜੀ ਗਲਤੀ ਕੀਤੀ ਹੈ ਉਸਨੂੰ ਮੈਂ ਕਿਸ ਤਰ੍ਹਾਂ ਸੰਭਾਲਿਆ ਹੈ ਇਸ ਕਰਕੇ ਗਲਤੀਆਂ ਤਾਂ ਬਹੁਤ ਹੀ ਹੋ ਜਾਂਦੀ ਹੈ ਮੇਰੇ ਕੋਲ ਪਰ ਮੈਂ ਫਿਰ ਵੀ ਆਪਣੇ ਆਪ ਨੂੰ ਸੰਭਾਲ ਲੈਂਦੀ ਹਾਂ ਕਿ ਕਿੱਦਾਂ ਗਲਤੀ ਨੂੰ ਠੀਕ ਹੋ ਸਕਦੀ ਹੈ ਇਸ ਤਰ੍ਹਾਂ ਹੀ ਇੱਕ ਵਾਰ ਮੇਰੇ ਸੋਹਰੇ ਮੇਰੇ ਕੋਲੋਂ ਇੱਕ ਗਲਤੀ ਹੋ ਗਈ ਸੀ ਅਤੇ ਸਬਜ਼ੀ ਵਿੱਚ ਨਮਕ ਜਿਆਦਾ ਪੈ ਗਿਆ ਸੀ ਅਤੇ ਫਿਰ ਮੈਂ ਉਸ ਗਲਤੀ ਨੂੰ ਠੀਕ ਕਰਨ ਵਾਸਤੇ ਦਹੀਂ ਉਸ ਮਸਾਲੇ ਦੇ ਵਿੱਚ ਦਹੀਂ ਨੂੰ ਤੜਕਾ ਲਗਾਇਆ ਅਤੇ ਜਿਸ ਕਰਕੇ ਜਿਹੜਾ ਹੈ ਉਹ ਨਮਕ ਉਹਦੇ ਵਿੱਚੋਂ ਥੋੜ੍ਹਾ ਘੱਟ ਗਿਆ ਸੀ ਇਸ ਕਰਕੇ ਸਬਜ਼ੀ ਦਾ ਸਵਾਦ ਜਿਹੜਾ ਹੈ ਉਹ ਬਦਲ ਗਿਆ ਸੀ ਅਤੇ ਸਬਜ਼ੀ ਬਾਅਦ ਚੋਂ ਸਭ ਨੂੰ ਠੀਕ ਲੱਗੀ ਸੀ ਅਤੇ ਨਮਕ ਦੀ ਕੁਆਂਟਿਟੀ ਜਿਹੜੀ ਹੈ ਉਹ ਵੀ ਥੋੜ੍ਹੀ ਘੱਟ ਗਈ ਸੀ ਉੱਤੋਂ ਮੈਂ ਥੋੜ੍ਹੀ ਜਿਹੀ ਕਸੂਰੀ ਮੌਥੀ ਉਦੇ ਮੇਥੀ ਉਹਦੇ ਵਿੱਚ ਪਾ ਦਿੱਤੀ ਸੀ ਜਿਹਦੇ ਨਾਲ ਮੇਥੀ ਦੀ ਵਾਸ਼ਨਾ ਵੀ ਉਹਦੇ ਵਿੱਚ ਆਈ ਅਤੇ ਮੇਥੀ ਦਾ ਸੁਆਦ ਵੀ ਉਹਦੇ ਵਿੱਚ ਪੈ ਗਿਆ ਅਤੇ ਤੜਕੇ ਦੇ ਵਿੱਚ ਇੱਕ ਤਾਂ ਦਹੀਂ ਦਾ ਤੜਕਾ ਲਗਾਉਣ ਦੇ ਨਾਲ ਉਹਦੇ ਵਿੱਚ ਨਮਕ ਦੀ ਮਾਤਰਾ ਘੱਟ ਹੋ ਗਈ ਦੂਜੀ ਮੇਥੀ ਪਾਉਣ ਦੇ ਨਾਲ ਉਸ ਦੇ ਵਿੱਚ ਸਵਾਦ ਆ ਗਿਆ ਅਤੇ ਨਾਲੇ ਨਮਕ ਵੀ ਜਿਹੜਾ ਹੈ ਉਹ ਥੋੜ੍ਹਾ ਘੱਟ ਹੋ ਗਿਆ ਇਸ ਤਰ੍ਹਾਂ ਮੈਂ ਆਪਣੀ ਗਲਤੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੰਭਾਲਿਆ ਅਤੇ ਦੁਬਾਰਾ ਉਹ ਗਲਤੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ